ਬਹੁਤ ਸਾਰੀਆਂ ਵਿਲੱਖਣ ਚੁਣੌਤੀਆਂ ਹਨ ਜੋ ਕਿ ਇੱਕ ਯਾਤਰੀ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਵੀ ਆਪਾਂ ਕਿਤੇ ਜਾਂਦੇ ਹਾਂ ਯਾਤਰਾ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਕੋਈ ਰੈਸਟ ਰੂਮ ਜਾਂ ਗੈਸਟ ਰੂਮ ਦੀ ਲੋੜ ਹੁੰਦੀ ਹੈ ਜਦੋਂ ਸਾਨੂੰ ਗੈਸਟ ਰੂਮ ਨਹੀਂ ਮਿਲਦਾ ਜਾਂ ਮਿਲ ਵੀ ਜਾਂਦਾ ਹੈ ਉਸ ਵਿੱਚ ਫੈਸਿਲਿਟੀਜ਼ ਨਹੀਂ ਹੁੰਦੀਆਂ ਜਿਵੇਂ ਕਿ ਕਈ ਵਾਰ ਗਰਮੀ ਵਿੱਚ ਸਾਨੂੰ ਰੈਸਟ ਰੂਮ ਵਿੱਚ ਏ ਸੀ ਜਾਂ ਕੂਲਰ ਦੀ ਲੋੜ ਹੁੰਦੀ ਹੈ ਪਰ ਕਈ ਰੈਸਟ ਰੂਮਾਂ ਵਿੱਚ ਇਹ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਹਨ ਤਾਂ ਇਹ ਵੀ ਯਾਤਰੀਆਂ ਨੂੰ ਬਹੁਤ ਹੀ ਸਾਹਮਣਾ ਕਰਨਾ ਪੈਂਦਾ ਹੈ ਜੇ ਦੇਖਿਆ ਜਾਵੇ ਤਾਂ ਕਈ ਵਾਰ ਸਾਨੂੰ ਗੈਸ ਦੀ ਵੀ ਲੋੜ ਹੁੰਦੀ ਹੈ ਕਈ ਕਾਰਾਂ ਜਿਵੇਂ ਕਿ ਗੈਸ 'ਤੇ ਚੱਲਦੀਆਂ ਹਨ ਅਤੇ ਜਿਹੜੀ ਕਿ ਗੈਸ ਸਟੇਸ਼ਨ ਬਹੁਤ ਹੀ ਦੂਰ ਦੂਰ 'ਤੇ ਮਿਲਦੇ ਹਨ ਅਤੇ ਸਾਨੂੰ ਗੈਸ ਦੀ ਪਹਿਲੋਂ ਲੋੜ ਹੁੰਦੀ ਹੈ ਉਹ ਵੀ ਸਾਨੂੰ ਬਹੁਤ ਹੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਵੀ ਸਾਡੇ ਲਈ ਬਹੁਤ ਹੀ ਵੱਡੀ ਗੱਲ ਹੈ ਜਦੋਂ ਵੀ ਆਪਾਂ ਕਿਸੇ ਯਾਤਰੀ ਦੇ ਰੂਪ ਵਿੱਚ ਜਾਂਦੇ ਹਾਂ ਤਾਂ ਸਾਨੂੰ ਭੋਜਨ ਦੀ ਵੀ ਬਹੁਤ ਲੋੜ ਹੁੰਦੀ ਹੈ ਪਰ ਜਦੋਂ ਆਪਾਂ ਕਿਸੇ ਦੂਜੇ ਏਰੀਏ ਵਿੱਚ ਜਾਂਦੇ ਹਾਂ ਤਾਂ ਸਾਨੂੰ ਉਹਨਾਂ ਦਾ ਭੋਜਨ ਨਹੀਂ ਪਸੰਦ ਆਉਂਦਾ ਜਾਂ ਸਾਨੂੰ ਆਪਣੇ ਭੋਜਨ ਦੀ ਕੋਈ ਚੀਜ਼ ਉਹਨਾਂ ਤੋਂ ਨਹੀਂ ਮਿਲਦੀ ਤਾਂ ਇਹ ਵੀ ਬਹੁਤ ਵੱਡੀ ਇੱਕ ਸਮੱਸਿਆ ਹੈ ਪਰ ਜਦੋਂ ਆਪਾਂ ਉਹਨਾਂ ਦੇ ਰਲ ਮਿਲ ਜਾਂਦੇ ਹਾਂ ਜਾਂ ਭੋਜਨ ਖਾਣਾ ਪਸੰਦ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਉਹ ਵੀ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਪਰ ਜਦੋਂ ਪਹਿਲੀ ਪਹਿਲੀ ਵਾਰ ਹਰ ਇੱਕ ਯਾਤਰੀ ਨੂੰ ਹੀ ਜਿਹੜੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਾਰੇ ਹੀ ਯਾਤਰੀ ਸਾਹਮਣਾ ਕਰਕੇ ਹੀ ਅੱਗੇ ਵੱਧਦੇ ਹਨ